ਨਮਸਤੇ ਮੈਂ ਪਰਮਜੀਤ ਕੌਰ ਗੁਰਦਾਸਪੁਰ ਤੋਂ ਹਾਂ ਮੈਂ ਸਰੀਰਕ ਕਾਫੀ ਬਿਮਾਰ ਰਹਿਣ ਲੱਗ ਪਿਆ ਸੀ ਅਤੇ ਮੇਰਾ ਸਰੀਰ ਮੋਟਾ ਵੀ ਹੋ ਗਿਆ ਸੀਗਾ ਜਿਸ ਕਰਕੇ ਮੈਨੂੰ ਚੱਲਣ ਫਿਰਨ ਵਿੱਚ ਦਿੱਕਤ ਹੁੰਦੀ ਸੀ ਪਰ ਮੈਂ ਯੋਗਾ ਕਲਾਸ ਕਰਦੀ ਸੀ ਸਾਡੇ ਯੋਗਾ ਕਲਾਸ ਲੱਗਦੀਆਂ ਸਨ ਸਵੇਰੇ ਛੇ ਤੋਂ ਅੱਠ ਜਾਂਦੀ ਸੀ ਅਤੇ ਸ਼ਾਮ ਨੂੰ ਛੇ ਤੋਂ ਸੱਤ ਜਾਂਦੀ ਸੀ ਅਤੇ ਸੈਰ ਵੀ ਕਰਦੀ ਸੀ ਅਤੇ ਇਸ ਤਰ੍ਹਾਂ ਨਵੇਂ ਨਵੇਂ ਤਰੀਕਿਆਂ ਨਾਲ ਯੋਗਾ ਕਰਨ ਨਾਲ ਮੇਰਾ ਸਰੀਰ ਥੱਕਿਆ ਰਹਿੰਦਾ ਸੀ ਪਰ ਮੈਂ ਯੋਗਾ ਰੋਜ਼ ਕਰਦੀ ਸੀ ਅਤੇ ਮੈਨੂੰ ਉਹ ਇੱਕ ਦਿਨ ਐਸਾ ਆਇਆ ਕਿ ਮੈਂ ਆਪਣਾ ਸਰੀਰ ਅਤੇ ਮਨ ਦੋਨੇਂ ਹੀ ਚੁਸਤ ਫੁਰਤ ਲੱਗਣ ਲੱਗ ਪਏ ਜਿਸ ਨਾਲ ਮੈਂ ਬਿਹਤਰ ਮਹਿਸੂਸ ਕਰਦੀ ਸੀ ਕਿ ਮੈਂ ਹੁਣ ਠੀਕ ਹਾਂ ਯੋਗਾ ਕਲਾਸ ਨਾਲ ਮੈਨੂੰ ਬਹੁਤ ਹੀ ਮਨ ਨੂੰ ਸ਼ਾਂਤੀ ਮਿਲਦੀ ਸੀ ਅਤੇ ਮੈਂ ਬਿਲਕੁਲ ਹੁਣ ਠੀਕ ਹਾਂ ਧੰਨਵਾਦ